ਇਸ ਸਥਾਨਕ ਨਗਰਪਾਲਿਕਾ ਨਾਲ ਸਰਕਾਰ ਉਸ ਵਿਸ਼ਿਆਂ ਪਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ ਅਤੇ ਵਿੱਚ ਹੋ ਗਏ ਤੁਸੀਂ ਪਾਰਕਾਂ ਦੇ ਵਿੱਚ ਬੂਟੇ ਲਗਵਾਉਣੇ ਸਾਫ਼ ਸਫਾਈ ਰੱਖਣੀ ਸ਼ਹਿਰ ਦੇ ਸੜਕਾਂ ਠੀਕ ਕਰਵਾਉਣੀਆਂ ਰਿਪੇਅਰ ਕਰਵਾਉਣੀ ਅਤੇ ਬਸ ਸਟੈਂਡ ਬਣਾਉਣੇ ਅਤੇ ਲਾਈਟਾਂ ਦਾ ਵੀ ਕੰਮ ਕਰਵਾਉਣਾ ਅਤੇ ਨਾਲਿਆਂ ਦੀ ਵੀ ਸਾਫ਼ ਸਫਾਈ ਕਰਵਾਉਂਦੀ ਹੈ ਅਤੇ ਨਾਲ ਹੀ ਇਹ ਪਾਣੀ ਦਾ ਇਹ ਸੀਵਰੇਜ ਦੀ ਵੀ ਸਪਲਾਈ ਠੀਕ ਪੱਧਰ ਦੇ ਮਿਲ ਕੇ ਕਰਦੀ ਹੈ ਅਤੇ ਇਹ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ ਅਤੇ ਹੋਰ ਤਰ੍ਹਾਂ ਦੇ ਵੀ ਕਈ ਕੰਮ ਰਲ਼ਕੇ ਕਰਦੀ ਹੈ ਅਤੇ ਇਹ ਸਰਕਾਰ ਇਹਨਾਂ ਨੂੰ ਇਸ ਕੰਮਾਂ ਵਾਸਤੇ ਬਜਟ ਪਾਸ ਕਰਦੀ ਹੈ